ਭੰਗੜੇ ਦੇ ਪ੍ਰਦਰਸ਼ਨ ਲਈ ਆਮ ਤੌਰ 'ਤੇ ਪਹਿਰਾਵਾ ਜੋ ਪਹਿਨਾਇਆ ਜਾਂਦਾ ਹੈ ਉਸ ਦੇ ਵਿੱਚ ਮੁੱਖ ਤੌਰ 'ਤੇ ਚਾਦਰਾ ਕੁੜਤਾ ਅਤੇ ਤੁਰਲੇ ਵਾਲੀ ਪੱਗ ਮਸ਼ਹੂਰ ਹੈ ਤੁਰਲੇ ਵਾਲੀ ਪੱਗ ਨੂੰ ਬੰਨ੍ਹਣ ਦਾ ਵੀ ਇੱਕ ਅਲੱਗ ਢੰਗ ਹੈ ਪਹਿਲਾ ਪੱਗ ਦੇ ਉਪਰ ਮਾਵਾ ਲਗਾਇਆ ਜਾਂਦਾ ਹੈ ਅਤੇ ਫਿਰ ਉਸ ਨੂੰ ਖੜ੍ਹਾ ਕੇ ਪੱਗ ਬੰਨ੍ਹੀ ਜਾਂਦੀ ਹੈ ਤਾਂ ਜੋ ਭੰਗੜਾ ਪਾਉਣ ਵੇਲੇ ਇਹ ਤੁਰਲਾ ਇੱਧਰ ਉੱਧਰ ਨਾ ਹੋਵੇ ਇਸ ਨੂੰ ਹੋਰ ਵੀ ਆਕਰਸ਼ਕ ਬਣਾਉਣ ਲਈ ਉਪ ਕੁੜਤੇ ਉੱਪਰ ਦੀ ਇੱਕ ਜੈਕਟ ਪਾਈ ਜਾਂਦੀ ਹੈ ਅਤੇ ਹੱਥ ਦੇ ਵਿੱਚ ਰੁਮਾਲ ਫੜ ਕੇ ਭੰਗੜਾ ਪਾਇਆ ਜਾਂਦਾ ਹੈ ਤਾਂ ਜੋ ਇਹ ਭੰਗੜਾ ਪਾਉਣ ਵਾਲਾ

ਜੋ ਭੰਗੜਾ ਪਾ ਰਿਹਾ ਇਹ ਸੋਹਣਾ ਲੱਗਦਾ ਹੈ ਇਸ ਤੋਂ ਇਲਾਵਾ ਪੈਰ ਦੇ ਵਿੱਚ ਕੱਢਮੀ ਜੁੱਤੀ ਅਤੇ ਗਲੇ ਦੇ ਵਿੱਚ ਕੈਂਠਾ ਅਤੇ ਹੱਥ ਵਿੱਚ ਸੰਮਾਂ ਵਾਲੀ ਡਾਂਗ ਭੰਗੜਾ ਪਾਉਣ ਵਾਲੇ 'ਤੇ ਬਹੁਤ ਸਜਦੀ ਹੈ ਹੋਰ ਵੀ ਇਹ ਪੌਸ਼ਾਕ ਇੰਨੀ ਚਮਕਦਾਰ ਹੁੰਦੀ ਹੈ ਕਿ ਸਟੇਜ ਦੇ ਉੱਪਰ ਜੋ ਵਿਅਕਤੀ ਭੰਗੜਾ ਪਾ ਰਿਹਾ ਹੈ ਉਹ ਇੰਨਾਂ ਕੁ ਸੋਹਣਾ ਲੱਗਦਾ ਹੈ ਕਿ ਭੰਗੜਾ ਪਾਉਣ ਦੇ ਨਾਲ ਨਾਲ ਸਭ ਦਾ ਮਨ ਮੋਹ ਲੈਂਦਾ ਹੈ ਭੰਗੜਾ ਦੇ ਹੋਰ ਵੀ ਕਈ ਇੰਸਟਰੂਮੈਂਟ ਬਣਾਏ ਗਏ ਹਨ ਜਿਸ ਤਰ੍ਹਾਂ ਕਾਟੋ ਜਾ ਸੰਮਾਂ ਵਾਲੀ ਡਾਂਗ ਉਹਨਾਂ ਨੂੰ ਵੀ ਸ਼ਿੰਗਾਰਿਆ ਜਾਂਦਾ ਹੈ ਅਤੇ ਉਹਨਾਂ ਉੱਪਰ ਵੀ ਰੁਮਾਲਾ ਵਗੈਰਾ ਬੰਨ੍ਹ ਕੇ ਉਹਨਾਂ ਨੂੰ ਹੋਰ ਸੋਹਣਾ ਬਣਾਇਆ ਜਾਂਦਾ ਹੈ